ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਮੈਂ ਡਾਂਸ ਦੀਆਂ ਰੀਲਾਂ ਦੇਖਦੀ ਸੀ ਅਤੇ ਮੇਰੀ ਵੀ ਡਾਂਸ ਕਰਨ ਦੀ ਇੱਛਾ ਹੁੰਦੀ ਸੀ ਫਿਰ ਮੈਂ ਹੌਲੀ ਹੌਲੀ ਆਪਣੀ ਭੈਣ ਤੋਂ ਡਾਂਸ ਸਿੱਖਣਾ ਸ਼ੁਰੂ ਕੀਤਾ ਉਹ ਬਹੁਤ ਸੋਹਣਾ ਡਾਂਸ ਕਰਦੀ ਹੈ ਮੈਂ ਰੀਲਾਂ ਵੇਖ ਕੇ ਵੀ ਬਹੁਤ ਸਾਰੇ ਸਟੈਪ ਸਿੱਖਦੀ ਸੀ ਅਤੇ ਹੌਲੀ ਹੌਲੀ ਮੈਂ ਵੀ ਡਾਂਸ ਵਿੱਚ ਬਿਹਤਰੀਨ ਹੁੰਦੀ ਗਈ ਮੈਂ ਜਦੋਂ ਪਹਿਲੀ ਵਾਰ ਕਲਾ ਉਤਸਵ ਵਿੱਚ ਗਈ ਤਾਂ ਮੈਂ ਤੀਸਰੀ ਪੁਜੀਸ਼ਨ ਹਾਸਲ ਕੀਤੀ ਮੈਂ ਆਪਣੇ ਸਕੂਲ ਵਿੱਚ ਵੀ ਬਹੁਤ ਵਾਰ ਡਾਂਸ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ ਅਤੇ ਬਹੁਤ ਸਾਰੇ ਪ੍ਰੋਗਰਾਮ ਜਿੱਤੀ ਵੀ ਹਾਂ ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਜਦੋਂ ਵੀ ਕੋਈ ਗਾਣਾ ਚੱਲਦਾ ਹੈ ਤਾਂ ਮੇਰੇ ਪੈਰ ਆਪਣੇ ਆਪ ਹੀ ਨੱਚਣ ਲੱਗ ਪੈਂਦੇ ਹਨ ਮੈਂ ਭੰਗੜਾ ਗਿੱਦਾ ਝੁੰਮਰ ਲੁੱਡੀ ਧਮਾਲ ਆਪ ਸਭ ਕੁਛ ਹੀ ਕਰ ਲੈਂਦੀ ਹਾਂ ਮੇਰੇ ਘਰ ਦੇ ਮੈਂਬਰਾਂ ਨੇ ਵੀ ਮੈਨੂੰ ਬਹੁਤ ਪ੍ਰੇਰਿਤ ਕੀਤਾ ਸਾਡੇ ਸਕੂਲ ਦੇ ਅਧਿਆਪਕ ਵੀ ਸਾਨੂੰ ਬਹੁਤ ਵਾਰ ਬਲਾਕ ਜ਼ਿਲ੍ਹਾ ਆਦਿ ਕਈ ਥਾਵਾਂ 'ਤੇ ਮੁਕਾਬਲਿਆਂ ਵਿੱਚ ਲੈ ਕੇ ਜਾਂਦੇ ਹਨ ਪਿਛਲੇ ਕੁਝ ਦਿਨਾਂ ਵਿੱਚ ਹੀ ਮੈਂ ਜ਼ਿਲ੍ਹਾ ਪੱਧਰ ਡਾਂਸ ਮੁਕਾਬਲੇ ਵਿੱਚ ਗਈ ਮੈਂ ਇੱਕ ਬਹੁਤ ਹੀ ਸੋਹਣਾ ਸੱਭਿਆਚਾਰਕ ਗੀਤ ਸੁਣਿਆ ਸੀ ਮੈਂ ਆਪਣੀ ਪੇਸ਼ਕਾਰੀ ਆਪਣੇ ਵੱਲੋਂ ਪੂਰੀ ਜੀਅ ਜਾਨ ਨਾਲ ਪੇਸ਼ ਕੀਤੀ ਮੇਰੇ ਜੱਜ ਸਾਹਿਬਾਨਾਂ ਨੂੰ ਵੀ ਮੇਰੀ ਪ੍ਰਦਰਸ਼ਨੀ ਮੇਰਾ ਚੁਣਿਆ ਸੱਭਿਆਚਾਰਕ ਗੀਤ ਜਿਸ ਦੇ ਉੱਤੇ ਮੈਂ ਡਾਂਸ ਕਰਿਆ ਸੀ ਉਹਨਾਂ ਨੂੰ ਬਹੁਤ ਪਸੰਦ ਆਇਆ ਇਸ ਤਰ੍ਹਾਂ ਮੈਂ ਆਪਣੇ ਕਾਲਜ ਵਿੱਚ ਵੀ ਬਹੁਤ ਸਤਿਕਾਰ ਪਾਇਆ ਹੈ ਮੈਨੂੰ ਬਹੁਤ ਸਾਰੇ ਮੈਡਲ ਵੀ ਮਿਲੇ ਹਨ